ਪੰਜਾਬ ਕਲਾ ਦਾ ਪੁਜਾਰੀ ਹੈ ਏਕਤਾ ਦੀ ਨਿਸ਼ਾਨੀ ਹੈ ਅਤੇ ਭਾਈਚਾਰੇ ਦੀ ਇੱਕ ਜੀਤਾ ਜਿਆਦਾ ਜੀਤਾ ਜਾਗਦਾ ਕਹਿ ਸਕਦੇ ਹਨ ਸਬੂਤ ਹੈ ਪਰ ਪੰਜਾਬ ਦੇ ਵਿੱਚ ਬੱਚਿਆਂ ਦੇ ਵਿੱਚ ਅਤੇ ਉਹਨਾਂ ਦੇ ਮਾਪਿਆਂ ਦੇ ਵਿੱਚ ਇੱਕ ਹੋੜ ਮੱਚੀ ਹੋਈ ਹੈ ਪੰਜਾਬ ਤੋਂ ਬਾਹਰ ਜਾਣ ਦੀ ਪੰਜਾਬ ਆਪੋ ਆਪਦੇ ਵਿੱਚ ਇੱਕ ਏਨਾ ਸੁੰਦਰ ਹੈ ਕਿ ਕੋਈ ਇਸਨੂੰ ਛੱਡ ਕਿਵੇਂ ਸਕਦਾ ਹੈ ਮੇਰਾ ਮੰਨਣਾ ਹੈ ਕਿ ਬੱਚੇ ਕਿਤੇ ਨਾ ਕਿਤੇ ਪੰਜਾਬ ਦੇ ਭਟਕ ਚੁੱਕੇ ਹਨ ਨਸ਼ਿਆਂ ਦੇ ਵਿੱਚ ਅਤੇ ਹੋਰ ਕੰਮਾਂ ਦੇ ਵਿੱਚ ਆ ਚੁੱਕੇ ਹੈ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਤੋਂ ਬਾਹਰ ਹੀ ਕਮਾਈ ਹੈ ਪੰਜਾਬ ਬੇਰੁਜ਼ਗਾਰ ਹੈ ਪਰ ਇਦਾਂ ਦਾ ਕੁੱਝ ਨਹੀਂ ਹੈ ਮੈਂ ਅੰਤ ਇਹੀ ਕਹਿਣਾ ਚਾਹਵਾਂਗੀ ਬੱਚਿਆਂ ਨੂੰ ਕਿ ਤੁਸੀਂ ਆਪਣੇ ਆਸ ਪਾਸ ਪਹਿਲਾਂ ਵੇਖੋ ਆਪਣੇ ਆਸ ਪਾਸ ਨੂੰ ਸਮਝੋ